ਹਾਂਜੀ ਮੈਂ ਟਰੈਵਲ ਏਜੰਟ ਗੁਰਮੀਤ ਸਿੰਘ ਨਾਲ ਗੱਲ ਕਰ ਰਿਹਾ ਜਿਨ੍ਹਾਂ ਦੀ ਕੰਪਨੀ ਆਰਤੀ ਟਰੈਵਲ ਏਜੰਸੀ ਹੈ ਮੈਂ ਦੱਸਣਾ ਚਾਹੁੰਦਾ ਹਾਂ ਵੀਰ ਜੀ ਮੈਂ ਜਿਸ ਰੇਟ ਗੱਡੀ ਰਾਹੀਂ ਜਾਣਾ ਚਾਹੁੰਦਾ ਹਾਂ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦਾ ਹਾਂ ਕੀ ਰੇਲ ਗੱਡੀ ਇਹ ਸਹੀ ਸਮੇਂ 'ਤੇ ਜਾਵੇਗੀ ਜਾਂ ਲੇਟ ਜਾਵੇਗੀ ਮੈਨੂੰ ਇਸ ਗੱਡੀ ਬਾਰੇ ਮਾਰਗ ਦਰਸ਼ਨ ਕੀਤਾ ਜਾਵੇ ਕਿਉਂਕਿ ਮੇਰੀ ਜਿਹੜੀ ਯਾਤਰਾ ਹੈ ਉਹ ਕਾਫ਼ੀ ਲੰਬੀ ਹੈ ਜਿਸ ਨਾਲ ਮੈਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਮੈਨੂੰ ਪਤਾ ਹੈ ਮੈਂ ਪਹਿਲਾਂ ਵੀ ਤੁਹਾਡੀ ਏਜੰਸੀ ਰਾਹੀਂ ਕਾਫ਼ੀ ਯਾਤਰਾਵਾਂ ਕੀਤੀਆਂ ਹਨ ਪਰ ਮੇਰੀ ਜਿਹੜੀ ਯਾਤਰਾ ਹੈ ਉਹ ਕਦੇ ਵੀ ਲੇਟ ਨਹੀਂ ਹੋਈ ਜਾਂ ਮੈਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੌਜੂਦਾ ਰੇਲ ਗੱਡੀ ਦੀ ਜਿਹੜੀ ਸਥਿਤੀ ਹੈ ਉਸ ਬਾਰੇ ਮੈਨੂੰ ਦੱਸਿਆ ਜਾਵੇ ਕਿ ਕੀ ਇਹ ਸਹੀ ਸਮੇਂ ਉੱਤੇ ਜਾਵੇਗੀ ਜਾਂ ਲੇਟ ਹੋਵੇਗੀ ਜਾਂ ਰਸਤੇ ਵਿੱਚ ਤੁਹਾਨੂੰ ਜ਼ਿਆਦਾ ਟਾਈਮ ਲਗਾਵੇਗੀ ਕਿਉਂਕਿ ਮੇਰਾ ਜਿਹੜਾ ਉੱਥੇ ਜਾਣ ਦਾ ਮਕਸਦ ਕਿਸੇ ਮੀਟਿੰਗ ਵਿੱਚ ਹਿੱਸਾ ਲੈਣਾ ਹੈ ਜੋ ਕਿ ਇੱਕ ਬਿਜ਼ਨਸ ਮੀਟਿੰਗ ਹੈ ਅਤੇ ਬਹੁਤ ਹੀ ਮਹੱਤਵਪੂਰਨ ਹੈ ਮੇਰੀ ਜ਼ਿੰਦਗੀ ਦੇ ਲਈ ਉਹ ਬਹੁਤ ਮਹੱਤਵਪੂਰਨ ਹੈ ਉੱਥੇ ਮੈਂ ਜਾ ਕੇ ਬਿਜਨਸ 'ਤੇ ਜਿਹੜੀ ਡੀਲ ਹੈ ਉਹ ਕਰਨੀ ਚਾਹੁੰਦਾ ਹਾਂ ਅਤੇ ਮੇਰੀ ਗੱਡੀ ਜੇ ਲੇਟ ਹੋ ਗਈ ਤਾਂ ਮੈਂ ਸਮੇਂ ਸਿਰ ਉਹ 'ਤੇ ਨਹੀਂ ਪਹੁੰਚ ਸਕਾਂਗਾ ਤਾਂ ਟਰੈਵਲ ਏਜੰਟ ਗੁਰਮੀਤ ਸਿੰਘ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੌਜੂਦਾ ਰੇਲ ਗੱਡੀ ਬਾਰੇ ਮੈਨੂੰ ਜਾਣਕਾਰੀ ਦਿਓ ਵੀ ਇਹ ਸਹੀ ਸਮੇਂ ਉੱਤੇ ਜਾਵੇਗੀ ਜਾਂ ਰਸਤੇ ਵਿੱਚ ਤਾਂ ਨਹੀਂ ਕਿਤੇ ਜ਼ਿਆਦਾ ਟਾਈਮ ਲਗਾਵੇਗੀ ਮੈਨੂੰ ਪਤਾ ਹੈ ਤੁਸੀਂ ਮੇਰਾ ਇਹ ਵਿਸ਼ਵਾਸ ਨਹੀਂ ਤੋੜੋਂਗੇ ਪਹਿਲਾਂ ਵੀ ਮੈਂ ਤੁਹਾਡੇ ਰਾਹੀਂ ਬਹੁਤ ਸਫ਼ਰ ਕੀਤਾ ਹੈ ਪਰ ਇਸ ਵਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਰੇਲ ਗੱਡੀਆਂ ਦੇ ਟਾਈਮ ਵਿੱਚ ਅਦਲਾ ਬਦਲੀ ਜਾਂ ਲੇਟ ਫੇਟ ਹੋ ਜਾਂਦੇ ਹਨ ਇਸ ਲਈ ਇਸ ਗੱਡੀ ਬਾਰੇ ਮੈਨੂੰ ਵਿਸਥਾਰ ਪੂਰਵਕ ਦੱਸਿਆ ਜਾਵੇ ਤੁਹਾਡਾ ਬਹੁਤ ਬਹੁਤ ਧੰਨ ਹੋ ਧੰਨਵਾਦ ਹੋਵੇਗਾ